ਸੈਲਫ ਹੈਲਪ ਗਰੁੱਪ ਬਾਰੇ ਮੇਰੀ ਰਾਏ ਕੁਛ ਇਸ ਪ੍ਰਕਾਰ ਹੈ ਜਿਵੇਂ ਕਿ ਸੈਲਫ ਹੈਲਪ ਗਰੁੱਪ ਵਿਅਕਤੀਆਂ ਨੂੰ ਆਤਮ ਨਿਰਭਰ ਬਣਾਉਣ ਵਿੱਚ ਬਹੁਤ ਮਦਦ ਕਰਦੇ ਹਨ ਖ਼ਾਸ ਕਰਕੇ ਮਹਿਲਾਵਾਂ ਗਰੀਬ ਵਰਗ ਅਤੇ ਗ੍ਰਾਮੀਣ ਖੇਤਰਾਂ ਵਿੱਚ ਸੈਲਫ ਹੈਲਪ ਗਰੁੱਪ ਦੇ ਫਾਇਦੇ ਕੁਛ ਇਸ ਤਰੀਕੇ ਹਨ ਜਿਵੇਂ ਕਿ ਆਰਥਿਕ ਸੁਭਾਵਲ ਸਵਾਬ ਲੰਬਨ ਇਹ ਗਰੁੱਪ ਲੋਨ ਨਿਵੇਸ਼ ਅਤੇ ਛੋਟੇ ਕਾਰੋਬਾਰ ਵਿੱਚ ਮਦਦ ਕਰਦੇ ਹਨ ਜਦੋਂ ਮਹਿਲਾ ਇਕੱਠੀਆਂ ਕੰਮ ਕਰਦੀਆਂ ਹਨ ਤਾਂ ਉਹਨਾਂ ਦੀ ਮੁਸ਼ਕਿਲਾਂ ਹੱਲ ਕਰਨ ਦੀ ਸਮਰੱਥਾ ਵੱਧਦੀ ਹੈ ਐੱਸ ਐੱਚ ਜੀ ਫਾਈਨੈਸ਼ਨਲ ਲਿਟਰੇਸੀ ਕਾਰੋਬਾਰ ਮਹਿਰਤਾ ਅਤੇ ਮਾਰਕੀਟ ਜੋੜ ਬਾਰੇ ਸਿੱਖਣ ਵਿੱਚ ਮਦਦ ਕਰਦੇ ਹਨ ਮਹਿਲਾਵਾਂ ਲਈ ਮੁਫ਼ਤ ਜਾਂ ਘੱਟ ਵਿਆਜ 'ਤੇ ਲੋਕ ਸਰਕਾਰੀ ਮਦਦ ਅਤੇ ਸਬਸਿਡੀ ਲੈਣ ਵਿੱਚ ਐਸ ਐਚ ਜੀ 'ਚ ਮਦਦ ਕਰਦੀਆਂ ਹਨ ਮਹਿਲਾਵਾਂ ਲਈ ਚੰਗੇ ਰੁਜ਼ਗਾਰ ਦੇ ਮੌਕੇ ਇਸ ਤਰੀਕੇ ਹਨ ਜਿਵੇਂ ਕਿ ਹੱਥੋਂ ਬਣੇ ਉਤਪਾਦ ਹੈਂਡਮੇਡ ਪ੍ਰੋਡਕਟਸ ਫੈਸ਼ਨ ਜਵੈਲਰੀ ਹਸਕਤਾ ਹੱਥੋਂ ਬਣੇ ਸਾਬਣ ਮੋਮਬੱਤੀਆਂ ਤਕਸ਼ੀਲ ਟੈਕਸਟਾਈਲ ਬਿਜਨਸ ਐਸ ਜੀ ਮਹਿਲਾਵਾਂ ਵਿੱਚ ਉਤਪਾਦ ਬਣਾ ਕੇ ਸਥਾਨਕ ਅਤੇ ਆਨਲਾਈਨ ਵਿਕਰੀ ਕਰ ਸਕਦੀਆਂ ਹਨ ਖੇਤੀ ਅਤੇ ਖਾਦ ਸਮੱਗਰੀਆਂ ਵਿੱਚ ਮਹਿਲਾਵਾਂ ਦੇ ਲਈ ਮੌਕੇ ਇਸ ਤਰੀਕੇ ਹਨ ਜਿਵੇਂ ਕਿ ਜੈਵਿਕ ਖੇਤੀ ਦੁੱਧ ਉਤਪਾਦ ਅਚਾਰ ਅਤੇ ਪਕਵਾਨ ਬਣਾ ਸਕਦੀਆਂ ਹਨ ਮਹਿਲਾਵਾਂ ਐਫ ਪੀ ਓਸ ਨਾਲ ਜੁੜ ਕੇ ਖੇਤੀ ਤੋਂ ਚੰਗੀ ਆਮਦਨ ਕਮਾ ਸਕਦੀਆਂ ਹਨ ਟੇਲਰਿੰਗ ਅਤੇ ਇਮਬਰੋਇਡਰੀ ਵਿੱਚ ਸੋਚ ਨੇ ਡਿਜ਼ਾਇਨਿੰਗ ਕੱਪੜਿਆਂ 'ਤੇ ਕਢਾਈ ਸੋਫਟ ਟੋਯਾਏਜ਼ ਬਣਾਉਣ ਵਿੱਚ ਘਰ ਬੈਠੇ ਕੰਮ ਚਲਾਉਣ ਅਤੇ ਔਨਲਾਈਨ ਵਿਕਰੀ ਵੀ ਹੋ ਸਕਦੀ ਹੈ